ਹੈਲੋ ਹਾਂਜੀ ਮੈਮ ਮੈਮ ਮੈਂ ਬੁਸ਼ਰਾ ਬਾਤ ਕਰ ਰਹੀ ਹਾਂ ਮੈਮ ਮੈਂ ਮੈਨੂੰ ਤੁਹਾਡੇ ਬਾਰੇ ਮੇਰੀ ਫ੍ਰੈਡ ਤੋਂ ਪਤਾ ਲੱਗਿਆ ਸੀ ਤੁਸੀਂ ਔਨਲਾਈਨ ਯੋਗਾ ਕਲਾਸਿਜ ਲੈਂਦੇ ਓ ਉਹਨਾਂ ਦੇ ਪ੍ਰਾਈਜ਼ ਕਿੰਨੀ ਫ਼ੀਸ ਕਿੰਨੀ ਲੱਗਣੀ ਐਕਚੁਅਲੀ ਸ਼ਾਮ ਦੀ ਕਿੰਨੀ ਫ਼ੀਸ ਹੋਣੀ ਸ਼ਾਮ ਦੀ ਕਿੰਨੀ ਅੱਛਾ ਜੀ ਅਤੇ ਮੈਂ ਸ਼ਾਮ ਵੇਲੇ ਹੀ ਫ਼ਰੀ ਹੁੰਦੀ ਹੈ ਪਰ ਤੁਹਾਡੀ ਫ਼ੀਸ ਤਾਂ ਜ਼ਿਆਦਾ ਹੈ ਜੀ ਮੈਂ ਤੁਹਾਨੂੰ ਤੀਨ ਹਜ਼ਾਰ ਤੱਕ ਪੇਅ ਕਰ ਸਕਦੀ ਹਾਂ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੀ ਹਾਂਜੀ ਹਾਂਜੀ ਅਤੇ ਮੈਂ ਯੋਗਾ ਪਹਿਲੇ ਵੀ ਯੋਗਾ ਦੀ ਕਲਾਸਿਜ ਲੈ ਰਹੀ ਆ ਅਤੇ ਮੈਨੂੰ ਉਹਦੇ ਕੀ ਕੀ ਬੈਨੀਫਿੱਟਸ ਹੋਣੇ ਹੈ ਤੁਸੀਂ ਦੱਸ ਸਕਦੇ ਓ ਮੈਨੂੰ ਅੱਛਾ ਜੀ ਠੀਕ ਹੈ ਜੀ ਔਰ ਇਹ ਕਿੰਨੇ ਦਿਨਾਂ ਤੱਕ ਚੱਲਣੀ ਹੈ ਕਲਾਸਿਜ਼ ਅੱਛਾ ਇਹਨਾਂ ਦੀ ਮਤਲਬ ਕੋਈ ਔਰ ਅਗਰ ਕਰਨਾ ਚਾਵੇ ਤਾਂ ਉਹਨਾਂ ਦੀ ਫ਼ੀਸ ਵੀ ਉਨ੍ਹੀਂ ਹੋਣੀ ਯਾਂ ਫਿਰ ਮੈਥੋ ਮੇਰੇ ਕਰਕੇ ਘੱਟ ਹੋਣੀ ਯਾਂ ਕਿੰਨੀ ਹੋਣੀ ਅੱਛਾ ਜੋ ਸਵੇਰੇ ਦੀ ਫ਼ੀਸ ਸਵੇਰੇ ਦੀ ਯੋਗਾ ਕਲਾਸਿਜ ਹੈ ਉਹਨਾਂ ਦੀ ਫ਼ੀਸ ਕਿੰਨੀ ਹੈ ਅੱਛਾ ਉਸ 'ਤੇ ਕੋਈ ਘੱਟ ਨੀ ਹੋ ਸਕਦੀ ਫ਼ੀਸ ਉਹ ਮੇਰੀ ਫ੍ਰੈਂਡ ਨੇ ਉੱਥੇ ਲੱਗਣਾ ਸਵੇਰੇ ਲਈ ਮੇਰੇ ਫ੍ਰੈਂਡ ਨੇ ਲੱਗਣਾ ਅਤੇ ਉਹਨਾਂ ਨੇ ਘੱਟ ਹੀ ਦੇਣਾ ਹੈ ਓਕੇ ਜੀ ਮੈਮ ਠੀਕ ਹੈ ਮੈਮ